ਮੋਹਾਲੀ ਜ਼ਿਲ੍ਹੇ ਵਿੱਚ ਮੌਸਮ ਬਹੁਤ ਵਧੀਆ ਰਹਿੰਦਾ ਹੈ ਇੱਕ ਤਾਂ ਮੇਨ ਕਾਰਨ ਇਸ ਦਾ ਹਿਮਾਚਲ ਦੇ ਨਾਲ਼ ਹੈ ਕਿਉਂਕਿ ਇਹ ਹਿਮਾਚਲ ਦੇ ਨਜ਼ਦੀਕ ਹੈ ਅਤੇ ਇੱਥੇ ਲੋਕਾਂ ਦੇ ਰੋਜ਼ਾਨਾ ਜੀਵਨ ਵਿੱਚ ਰੁੱਤਾਂ ਦਾ ਅਸਰ ਵਧੀਆ ਪੈਂਦਾ ਹੈ ਕਿਉਂਕਿ ਇੱਕ ਤਾਂ ਇੱਥੇ ਮੋਹਾਲੀ ਵਿੱਚ ਵੈਸੇ ਹੀ ਸ਼ਹਿਰ ਵਧੀਆ ਹੈ ਅਤੇ ਇਹਦੇ 'ਚ ਗ੍ਰੀਨ ਜਿਵੇਂ ਕਿ ਦਰੱਖਤ ਬਹੁਤ ਹਨ ਅਤੇ ਠੰਡੀਆਂ ਹਵਾਵਾਂ ਚਲਦੀਆਂ ਹਨ ਅਤੇ ਉਹਨਾਂ ਦੇ ਕਾਰਨ ਲੋਕਾਂ ਦੇ ਆਮ ਜੀਵਨ ਵਿੱਚ ਆਕਸੀਜਨ ਦੀ ਜਿਵੇਂ ਕਿ ਕਹਿ ਦਿੰਦੇ ਹਨ ਵੀ ਲ ਆਕਸੀਜਨ ਦੀ ਭ ਭਰਪੂਰ ਮਾਤਰਾ ਹੈ ਅਤੇ ਇਸ ਲਈ ਇੱਕ ਤਾਂ ਮੋਹਾਲੀ ਸ਼ਹਿਰ ਵੈਸੇ ਵੀ ਵਧੀਆ ਸ਼ਹਿਰ ਮੰਨਿਆ ਜਾਂਦਾ ਹੈ ਅਤੇ ਰੁੱਤਾਂ ਦੇ ਕਾਰਨ ਵੀ ਇਸ ਨਾਲ਼ ਲੋਕ ਜ਼ਿਆਦਾ ਇੱਥੋਂ ਪਸੰਦ ਰਹਿਣਾ ਕਰਦੇ ਹਨ